ਮੈਨੂੰ ਆਪਣੇ ਰੋਜ਼ ਜਾਣ ਆਣ ਵਾਸਤੇ ਇੱਕ ਨਾ ਘੜੀ ਦੀ ਲੋੜ ਸੀ ਅਤੇ ਮੈਂ ਕਿਹਾ ਚੱਲ ਮੈਂ ਇਸ ਵਾਰ ਨਾ ਆਨਲਾਈਨ ਘੜੀ ਮੰਗਵਾ ਲੈਂਦੀ ਹਾਂ ਅਤੇ ਮੈਂ ਘੜੀ ਮੰਗਵਾਉਣ ਲਈ ਐਮਾਜੋਨ ਦੇਖਿਆ ਅਤੇ ਉਹਦੇ ਵਿੱਚ ਘੜੀ ਦਾ ਜਿਹੜਾ ਰੇਟ ਸੀ ਉਹ ਕਾਫੀ ਜ਼ਿਆਦਾ ਸੀ ਇਸ ਲਈ ਮੈਂ ਦੋ ਤਿੰਨ ਕੰਪਨੀਆਂ ਦੇਖੀਆਂ ਜਿਵੇਂ ਫਲਿੱਪਕਾਰਟ ਸ਼ੋਪਸੀ ਅਤੇ ਮੈਨੂੰ ਹੁਣ ਜੀ ਫਲਿੱਪਕਾਰਟ ਤੋਂ ਘੜੀ ਬਹੁਤ ਪਸੰਦ ਆ ਗਈ ਅਤੇ ਮੈਂ ਕਿਹਾ ਚੱਲ ਮੈਂ ਇਹ ਘੜੀ ਲੈ ਲੈਂਦੀ ਹਾਂ ਮੈਂ ਇਹਨੂੰ ਆਨਲਾਈਨ ਹੀ ਮੰਗਵਾਉਣਾ ਚਾਹੁੰਦੀ ਸੀ ਅਤੇ ਫਿਰ ਮੈਂ ਨਾ ਆਪਣਾ ਇੱਕ ਪ੍ਰੋਮੋ ਕੋਡ ਦਰਜ ਕੀਤਾ ਅਤੇ ਜਿਹਦੇ ਨਾਲ ਕਿ ਮੈਨੂੰ ਨਾ ਘੜੀ ਦੇ ਵਿੱਚ ਛੂਟ ਮਿਲ ਰਹੀ ਸੀ ਅਤੇ ਮੈਂ ਕਿਹਾ ਕਿਉਂ ਨਾ ਮੈਂ ਪ੍ਰੋਮੋ ਕੋਡ ਨੂੰ ਐਂਟਰ ਕਰਵਾ ਕੇ ਅਤੇ ਛੋ ਛੂਟ ਲਈ ਜਾਵੇ ਪਰ ਮੈਨੂੰ ਨਾ ਜ਼ਿਆਦਾ ਪ੍ਰੋਮੋ ਕੋਡ ਬਾਰੇ ਨੌਲੇਜ ਨਹੀਂ ਸੀ ਮੈਂ ਕਿਹਾ ਕਿਤੇ ਇਹ ਮੇਰੇ ਯੇ ਚੱਲੇ ਨਾ ਚੱਲੇ ਕੀ ਪਤਾ ਕੋਈ ਧੋਖਾ ਧੜੀ ਦਾ ਮਾਮਲਾ ਹੀ ਨਾ ਹੋਵੇ ਕਿ ਕੋਡ ਵੀ ਲੈ ਲੈਣ ਅਤੇ ਫਿਰ ਮੈਨੂੰ ਘੜੀ ਵੀ ਨਾ ਮਿਲੇ ਪਰ ਫਿਰ ਮੈਨੂੰ ਮੇਰੇ ਜਾਣਕਾਰ ਨੇ ਦੱਸਿਆ ਕਿ ਨਹੀਂ ਮੈਂ ਵੀ ਇੱਦਾਂ ਇੱਕ ਚੀਜ਼ ਮੰਗਵਾਈ ਸੀ ਅਤੇ ਵੀ ਮੈਂ ਵੀ ਆਪਣਾ ਕੋਡ ਲਾਇਆ ਅਤੇ ਮੈਨੂੰ ਉਹਦੇ ਵਿੱਚ ਕਾਫੀ ਛੂਟ ਮਿਲ ਗਈ ਅਤੇ ਜੀ ਮੈਨੂੰ ਇਸ ਕਰਕੇ ਮੈਨੂੰ ਔਨਲਾਈਨ ਜਿਹੜੀ ਚੀਜ਼ ਮੈਨੂੰ ਸਸਤੀ ਮਿਲ ਗਈ ਅਤੇ ਮੈਂ ਕਿਹਾ ਚੱਲ ਦੇਖਦੀ ਹਾਂ ਮੈਂ ਵੀ ਇਹ ਕਰਕੇ ਅਤੇ ਮੈਂ ਨਾ ਫਿਰ ਆਨਲਾਈਨ ਹੀ ਘੜੀ ਲਈ ਇੱਕ ਪ੍ਰੋਮੋ ਕੋਡ ਬਣਾਇਆ ਅਤੇ ਮੈਂ ਚੈੱਕਆਊਟ ਕਰਨ ਲਈ ਫਿਰ ਮੈਂ ਜਦੋਂ ਉਹ ਉਹ ਪ੍ਰੋਮੋ ਕੋਡ ਲਾਇਆ ਤਾਂ ਜਿਹੜੀ ਘੜੀ ਮੈਨੂੰ ਉੱਥੇ ਪੰਦਰ੍ਹਾਂ ਸੌ ਦੀ ਮਿਲ ਰਹੀ ਸੀ ਤਾਂ ਮੈਨੂੰ ਉਹ ਕੋਡ ਲਗਾਉਣ ਨਾਲ ਜਿਹੜੀ ਘੜੀ ਹੈ ਮੈਨੂੰ ਤਿੰਨ ਸੌ ਰੁਪਈਆ ਸਸਤੀ ਮਿਲ ਗਈ ਅਤੇ ਮੈਂ ਇਹ ਸਾਰੀ ਗੱਲ ਆਪਣੇ ਸਾਰੇ ਦੋਸਤਾਂ ਨੂੰ ਦੱਸੀ ਅਤੇ ਉਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਵੀ ਜਦੋਂ ਕੁਝ ਵੀ ਆਨਲਾਈਨ ਚੀਜ਼ ਮੰਗਵਾਂਦੇ ਹੋ ਤਾਂ ਤੁਸੀਂ ਵੀ ਇਸ ਤਰ੍ਹਾਂ ਦਾ ਨੋਲੇਜ ਰੱਖੋ ਜੇ ਅਸੀਂ ਆਪਦਾ ਕੋਈ ਪ੍ਰੋਮੋ ਕੋਡ ਦਰਜ ਕਰਦੇ ਹਾਂ ਤਾਂ ਸਾਨੂੰ ਚੈੱਕਆਊਟ ਕਰਦੇ ਸਮੇਂ ਜਿਹੜੀ ਹੈ ਹਰ ਇੱਕ ਚੀਜ਼ ਦੇ ਵਿੱਚ ਛੂਟ ਮਿਲ ਜਾਂਦੀ ਹੈ ਧੰਨਵਾਦ